ਹਾਂ ਨਮਸਤੇ ਹੋਰ ਠੀਕ ਹੋ ਵਧੀਆ ਵਧੀਆ ਤੁਸੀਂ ਆਪਣਾ ਹਾਂਜੀ ਬ ਮੀਂਹ ਤਾਂ ਬਹੁਤ ਜ਼ਿਆਦਾ ਪੈ ਰਿਹਾਂ ਹਾਂਜੀ ਵਾ ਵਧੀਆ ਹੋਰ ਆਪਣਾ ਘਰ ਪਰਿਵਾਰ ਠੀਕ ਹੈ ਹਾਂਜੀ ਗਰਮੀ ਬਹੁਤ ਜ਼ਿਆਦਾ ਹਾਂਜੀ ਮੈਂ ਜ਼ਿਆਦਾ ਐਂ ਕੀਤਾ ਵੀ ਬੱਚਿਆਂ ਨੂੰ ਹੁਣ ਅੱਗੇ ਪੜ੍ਹਨ ਲਾਉਣਾ ਗਾ ਕਲਾਸ ਹੁਣ ਆਹ ਨਵੀਂ ਚੱਲ ਸ਼ੁਰੂ ਹੋ ਗਈ ਹਾਂ ਹਾਂ ਵੀ ਹੁਣ ਦੱਸੋ ਹੁਣ ਕਿੱਧਰ ਲਾਉਣਾ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਘੱਟ ਪੜ੍ਹੀ ਹੈ ਹੈ ਨਾ ਹੁਣ ਤੁਸੀਂ ਇਨ੍ਹਾਂ ਬਾਰੇ ਪਤਾ ਕਰੋ ਹਾਂ ਹਾਂ ਹਾਂ ਹਾਂ ਹਾਂਜੀ ਬਸ ਫਿਰ ਤੁਸੀਂ ਪਤਾ ਕਰੋ ਹੁਣ ਮੈਂ ਤੁਹਾਡੇ 'ਤੇ ਗੱਲ ਸਿੱਟੀ ਹੈ ਵੀ ਇਹ ਤੁਸੀਂ ਪਤਾ ਕਰਨਾ ਹੈ ਵੀ ਕਿਹੜੇ ਸਕੂਲ ਵਧੀਆ ਆਪਣਾ ਬੱਚਾ ਕੀ ਸਹੀ ਸਕੂਲ ਦੇ ਵਿੱਚ ਪੜ੍ਹ ਰਿਹਾ ਗਾ ਅਤੇ ਨਾਲੇ ਕੁਛ ਨਾ ਕੁਛ ਪਤਾ ਲੱਗ ਜਾਣਾ ਆਪਾਂ ਨੂੰ ਹਾਂ ਹੁਣ ਹੁਣੀ ਹਾਂ ਹਾਂ ਇਹ ਤਾਂ

ਅੱਛਾ ਅੱਛਾ ਹਾਂਜੀ ਹਾਂਜੀ ਅੱਛਾ ਹਾਂਜੀ ਬਸ ਇਹ ਹੀ ਪਤਾ ਕਰਨਾ ਵੀ ਆਪਣੇ ਬੱਚੇ ਇਕੱਠੇ ਸ਼ੁਰੂ ਤੋਂ ਹੀ ਜਾਂਦੇ ਹੈ ਸ਼ੁਰੂ ਤੋਂ ਹੀ ਇਕੱਠੇ ਵੈਨ 'ਤੇ ਸਮਾਰ ਕੇ ਸਾਰੇ ਵੈਨ ਦਾ ਖਰਚਾ ਪਤਾ ਕਰ ਲਿਓ ਸਕੂਲ ਦਾ ਪਤਾ ਕਰ ਲਿਓ ਫੀਸ ਦਾ ਪਤਾ ਕਰ ਲਿਓ ਵੀ ਕਿੰਨੀ ਹੈ ਅਤੇ ਹਾਂ

ਹਾਂ ਹਾਂ

ਹਾਂ ਕਿਓਂ ਫਿਰ ਬਸ ਆਪਾਂ ਨੂੰ ਟਿਊਸ਼ਨ ਲਾਉਣ ਦੀ ਲੋੜ ਨਹੀਂ ਪੈਂਦੀ ਬੱਚੇ ਨੂੰ ਜੇ ਅੱਗੇ ਆਪਾਂ ਨੂੰ ਸਕੂਲ ਹੀ ਵਧੀਆ ਮਿਲ ਜਾਵੇ ਟਿਊਸ਼ਨ ਦੀ ਲੋੜ ਨਹੀਂ ਹਾਂ ਇਹ ਤਾਂ ਹੈ ਸਾਰਾ ਦੇਖ ਕੇ ਨਾ ਸਾਰਾ ਕਰ ਲਿਓ

ਹਾਂ ਹਾਂ ਤੁਸੀਂ ਸਮਾਰ ਕੇ ਕਰਕੇ ਪਤਾ ਨਾ ਚਲੋ ਠੀਕ ਠੀਕ ਹੈ ਹੈਂ ਹੋਰ ਸਾਰੇ ਵਧੀਆ ਹਾਂ ਠੀਕ ਹੈ ਓਕੇ ਬਾਏ